ਨੌ ਜੂਨ ਉੱਨੀ ਸੌ ਨੜਿਨਵੇਂ ਛੱਬੀ ਜਨਵਰੀ ਦੋ ਹਜ਼ਾਰ ਪੰਜ ਗਿਆਰਾਂ ਅਪ੍ਰੈਲ ਉੱਨੀ ਸੌ ਅਠਾਨਵੇਂ ਛੱਬੀ ਅਕਤੂਬਰ ਉੱਨੀ ਸੌ ਤ੍ਰਿਆਨਵੇਂ ਸੋਲ੍ਹਾਂ ਜੂਨ ਦੋ ਹਜ਼ਾਰ ਗਿਆਰਾਂ